ਸਤਿ ਸ਼੍ਰੀ ਅਕਾਲ ਸਰ ਤੁਸੀਂ ਰਾਹੁਲ ਦੇ ਪੇਰੇਂਟ ਬੋਲਦੇ ਕਰਦੇ ਹੋ ਸਰ ਜੀ ਤੁਹਾਨੂੰ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਸਾਡੇ ਸਕੂਲ ਵੱਲੋਂ ਨਾ ਇੱਕ ਵੰਡਰਲੈਂਡ ਨੂੰ ਟਰਿੱਪ ਜਾਣਡੀ ਹੈ ਅਤੇ ਹਾਂਜੀ ਹਾਂਜੀ ਹਾਂਜੀ ਮੈਂ ਰਾਹੁਲ ਦਾ ਇੰਚਾਰਜ ਬੋਲਿਆ ਕਰਨਾ ਅਤੇ ਸਾਡੇ ਸਕੂਲ ਵੱਲੋਂ ਟਰਿੱਪ ਜਾਣਡੀ ਅਤੇ ਤੁਸੀਂ ਰਾਹੁਲ ਨੂੰ ਭੇਜਣਾ ਚਾਹੁੰਦੇ ਹੋ ਹਾਂਜੀ ਹਾਂਜੀ ਅਤੇ ਤੁਸੀਂ ਸਹਿਮਤ ਹੋ ਇਹਦੀ ਫ਼ੀਸ ਸਾਰੀ ਗਿਆਰਾਂ ਸੌ ਰੁਪਈਆ ਹੋਣਾ

ਉਹ ਸਾਰਾ ਵਿੱਚ ਵਿੱਚ ਹੀ ਵਿੱਚ ਹੀ ਵਿੱਚ ਹੀ ਭਾਅ ਜੀ ਉਹ ਸਭ ਵਿੱਚ ਹੀ ਆਏਗਾ ਅਤੇ ਜੋ ਰਾਹੁਲ ਕੁਝ ਖਾਣ ਪੀਣ ਨੂੰ ਲਿਆਉਣਾ ਚਾਹੁੰਦਾ ਉਹ ਵੀ ਲਿਆ ਸਕਦਾ ਜਿੱਦਾਂ ਰੋਟੀ ਸਾਡੇ ਵੱਲੋਂ ਹੀ ਹੋਣੀ ਹੈ ਅਤੇ ਬਸ ਆ ਸਵੇਰੇ ਇਹਨਾਂ ਨੂੰ ਅੱਠ ਵਜੇ ਭੇਜ ਦਿਓ ਅਤੇ ਨੌਂ ਵਜੇ ਲੈਣ ਆ ਜਾਇਓ ਸਕੂਲ ਸਕੂਲ 'ਚ ਹੀ ਲੈਣ ਆਉਣ ਠੀਕ ਹੈ ਠੀਕ ਹੈ